ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਅਜੀਬ ਘਟਨਾਵਾਂ ਹੁੰਦੀਆਂ ਹਨ ਜਿਵੇਂ ਕਿ ਸਾਡੇ ਦਿਲ ਔਰ ਦਿਮਾਗ 'ਤੇ ਜਿਹਦਾ ਗਹਿਰਾ ਅਸਰ ਹੁੰਦਾ ਹੈ ਮੈਂ ਜਦੋਂ ਮੇਰੀ ਸ਼ਾਦੀ ਹੋਈ ਉਸ ਵੇਲੇ ਮੈਂ ਹਨੀਮੂਨ ਲਈ ਸ਼੍ਰੀਨਗਰ ਗਿਆ ਔਰ ਉੱਥੋਂ ਦੇ ਆਬੋ ਹਵਾਤ ਹਵਾ ਦੇਖ ਕੇ ਮਨ ਪ੍ਰਸੰਨ ਹੋ ਗਿਆ ਔਰ ਉਹ ਉੱਨੀ ਸੌ ਪਚਾਸੀ ਦੀ ਗੱਲ ਹੈ ਜਿਸ ਵੇਲੇ ਅਸੀਂ ਉੱਥੋਂ ਦੇ ਸਾਈਡ ਦੇ ਲੋਕੇਸ਼ਨਸ 'ਤੇ ਗਏ ਜਿਵੇਂ ਕਿ ਗੁੱਲਮਰਗ ਸੌਨਮਰਗ ਅਮਰਨਾਥ ਉੱਥੋਂ ਦੇ ਇਹ ਨਜ਼ਾਰੇ ਦੇਖ ਕੇ ਬਹੁਤ ਆਨੰਦ ਆਇਆ ਅਤੇ ਸਾਨੂੰ ਇਹ ਲੱਗਦਾ ਸੀ ਕਿ ਇਹ ਇੰਡੀਆ ਦਾ ਇੱਕ ਪੱਕਾ ਦੇਸ਼ ਬਣਨਾ ਚਾਹੀਦਾ ਹੈ ਧਾਰਾ ਤਿੰਨ ਸੌ ਸੱਤਰ ਖਤਮ ਹੋਣੀ ਚਾਹੀਦੀ ਹੈ ਜਿਹੜੀ ਕਿ ਖਤਮ ਹੋ ਚੁੱਕੀ ਹੈ ਜਿਹਦੇ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਹੁਣ ਉੱਥੇ ਵੀ ਆਪਣਾ ਜਿਹੜਾ ਜ਼ਮੀਨ ਜਾਇਦਾਦ ਖ਼ਰੀਦ ਸਕਦੇ ਹਾਂ ਅਤੇ ਆਪਣਾ ਰਹਿਣ ਬਸੇਰਾ ਉੱਥੇ ਵੀ ਬਣਾ ਸਕਦੇ ਹਾਂ